ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਕੁਮਾਰ ਰਸੋਈ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਰੈਸਟੋਰੈਂਟ ਤੋਂ ਕੁਛ ਔਡਰ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਮੇਰੇ ਦੋਸਤਾਂ ਨੇ ਦੱਸਿਆ ਹੈ ਕਿ ਇੱਥੇ ਰੈਸਟੋਰੈਂਟ ਦੇ ਵਿੱਚ ਹਰੇਕ ਚੀਜ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਵਾਦਿਸ਼ਟ ਹੁੰਦੀ ਹੈ ਪਰ ਜਿਹੜੀ ਤੁਹਾਡੇ ਰੈਸਟੋਰੈਂਟ ਦੀ ਫੇਮੱਸ ਚੀਜ਼ ਜਿਹੜੀ ਮੈਨੂੰ ਪਤਾ ਚੱਲੀ ਹੈ ਉਹਦਾ ਨਾਮ ਹੈ ਸ਼ਾਹੀ ਪਨੀਰ ਤਾਂ ਇਸ ਕਰਕੇ ਮੈਂ ਸ਼ਾਹੀ ਪਨੀਰ ਔਡਰ ਕਰਨਾ ਚਾਹੂੰਗੀ ਕਿਉਂਕਿ ਮੇਰੇ ਘਰ ਅੱਜ ਇੱਕ ਛੋਟੀ ਜਿਹੀ ਪਾਰਟੀ ਹੈ ਅਤੇ ਉਹਦੇ ਵਿੱਚ ਮੈਂ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਦੋਸਤਾਂ ਨੂੰ ਵੀ ਇੱਥੇ ਦੇ ਰੈਸਟੋਰੈਂਟ ਦਾ ਟੇਸਟ ਕਰਾਂਵਾ ਅਤੇ ਇਸ ਦੇ ਨਾਲ਼ ਈ ਮੈਂ ਦੋ ਚਾਰ ਆਈਟਮਾਂ ਹੋਰ ਵੀ ਔਡਰ ਕਰਨਾ ਚਾਹੂੰਗੀ ਇੱਕ ਦਾਲ ਮੱਖਣੀ ਇੱਕ ਬਰਿਆਨੀ ਅਤੇ ਇੱਕ ਮਲਾਈ ਕੋਫਤਾ ਅਤੇ ਨਾਲ਼ ਹੀ ਰੋਟੀਆਂ ਦੇ ਵਿੱਚ ਬਟਰ ਨਾਨ ਲੱਛਾ ਪਰਾਂਠਾ ਅਤੇ ਮਿੱਸੀ ਰੋਟੀ ਔਰ ਮੈਂ ਜਿਹੜੀ ਪੇਮੈਂਟ ਆ ਤੁਹਾਨੂੰ ਔਨਲਾਈਨ ਕਰ ਦਾਂਗੀ ਜੇ ਤੁਸੀਂ ਚਾਹੋ ਤਾਂ ਔਫਲਾਈਨ ਤਾਂ ਮੈਂ ਔਫਲਾਈਨ ਵੀ ਕਰ ਸਕਦੀ ਹਾਂ ਬਟ ਜਿਵੇਂ ਤੁਹਾਨੂੰ ਠੀਕ ਲੱਗੇਗਾ ਤੁਸੀਂ ਮੈਨੂੰ ਉਸਦੇ ਹਿਸਾਬ ਨਾਲ਼ ਦੱਸ ਦਿਓ ਅਤੇ ਮੇਰਾ ਜਿਹੜਾ ਔਡਰ ਹੈ ਉਹ ਮੇਰੇ ਐਡਰੈੱਸ 'ਤੇ ਭੇਜ ਦਿੱਤਾ ਜਾਵੇ ਮੇਰਾ ਐਡਰੈੱਸ ਹੈਗਾ ਅੱਠ ਫੇਸ ਮੋਹਾਲੀ ਅਤੇ ਜਿੰਨੀ ਜਲਦੀ ਮੇਰਾ ਔਡਰ ਆਏਗਾ ਮੈਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੀ ਧੰਨਵਾਦ